ਮੈਨੂੰ ਸ਼ੁਰੂ ਤੋਂ ਹੀ ਕੁਕਿੰਗ ਦਾ ਬਹੁਤ ਸ਼ੌਂਕ ਹੈ ਔਰ ਮੈਂ ਨਵੀਆਂ ਨਵੀਆਂ ਚੀਜ਼ਾਂ ਨੂੰ ਟਰਾਈ ਕਰਦੀ ਰਹਿੰਦੀ ਹਾਂ ਕਿ ਕਿਸ ਤਰ੍ਹਾਂ ਮੈਂ ਕੋਈ ਨਵੀਂ ਚੀਜ਼ ਬਣਾਵਾਂ ਔਰ ਦੂਸਰਿਆਂ ਨੂੰ ਖਿਲਾਵਾਂ ਪਾਲਕ ਪਨੀਰ ਤਾਂ ਮੈਂ ਬਹੁਤ ਵਾਰੀ ਬਣਾਇਆ ਇੱਕ ਵਾਰੀ ਮੇਰੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਪਾਲਕ ਦੇ ਕੋਫਤੇ ਬਣਾਏ ਜਾਣ ਫਿਰ ਮੈਂ ਪਾਲਕ ਦੇ ਕੋਫਤੇ ਬਣਾਉਣ ਲਈ ਸਭ ਤੋਂ ਪਹਿਲੇ ਪਾਲਕ ਨੂੰ ਔਰ ਆਲੂਆਂ ਨੂੰ ਬਾਇਲ ਕੀਤਾ ਫਿਰ ਮੈਂ ਬਰੈਡ ਦੇ ਸਲਾਈਸਿਸ ਲੈ ਕੇ ਆਲੂ ਮੈਸ਼ ਕਰਕੇ ਉਹਦੇ ਵਿੱਚ ਲਗਾ ਕੇ ਪਾਲਕ ਲਗਾਈ ਔਰ ਪਿਆਜ ਟਮਾਟਰ ਵਿੱਚ ਬਰੀਕ ਬਰੀਕ ਕੱਟ ਕੇ ਉਹ ਪਾ ਕੇ ਉਹਨੂੰ ਬੰਦ ਉਹਦੇ ਬੋਲਸ ਬਣਾ ਕੇ ਉਹਨਾਂ ਨੂੰ ਫਰਾਈ ਕਰਕੇ ਫਿਰ ਮੈਂ ਉਹਦੀ ਗਰੇਵੀ ਬਣਾਈ ਗਰੇਵੀ ਬਣਾ ਕੇ ਫਿਰ ਜ ਦਸ ਮਿੰਟ ਉਹਨੂੰ ਬੋਇਲ ਕਰਕੇ ਫਿਰ ਮੈਂ ਉਹਦੇ ਵਿੱਚ ਜਿਹੜੇ ਪਾਲਕ ਦੇ ਕੋਫਤੇ ਬਣਾਏ ਸੀਗੇ ਉਹ ਵਿੱਚ ਪਾ ਕੇ ਉਹਨਾਂ ਨੂੰ ਦਸ ਮਿੰਟ ਦੀ ਕੁਕਿੰਗ ਕੀਤੀ ਫਿਰ ਜਦੋਂ ਮੈਂ ਉਹਨਾਂ ਨੂੰ ਪਾਲਕ ਦੇ ਕੋਫਤੇ ਬਣਾਏ ਉਹਨਾਂ ਨੂੰ ਮੈਂ ਸਰਵ ਕੀਤਾ ਅਤੇ ਸਾਰਿਆਂ ਨੇ ਬਹੁਤ ਪਸੰਦ ਕੀਤੇ